ਅੱਜ ਤੋਂ ਇੱਕ ਮਹਿਨਾ ਪਹਿਲਾਂ ਅਸੀਂ ਰੋਪੜ ਤੋਂ ਲਹਿਰੀ ਸ਼ਾਹ ਮੰਦਿਰ ਕੋਲ ਲੋਇਡ ਕੰਪਨੀ ਦੀ ਚਾਲ਼ੀ ਹਜ਼ਾਰ ਦੀ ਐਲ ਈ ਡੀ ਲਿਆਂਦੀ ਜੋ ਕਿ ਇੱਕ ਮਹੀਨੇ ਤੋਂ ਬਾਅਦ ਖਰਾਬ ਹੋ ਗਈ ਅਤੇ ਅਸੀਂ ਉਸ ਦੁਕਾਨ 'ਤੇ ਲੈ ਕੇ ਗਏ ਤਾਂ ਦੁਕਾਨਦਾਰ ਨੇ ਦੁਕਾਨਦਾਰ ਨੇ ਵਾਪਿਸ ਨਹੀਂ ਕਰੀ ਠੀਕ ਨਹੀਂ ਕਰੀ ਅਤੇ ਨਾ ਹੀ ਸਾਨੂੰ ਪੈਸੇ ਦਿੱਤੇ ਅਤੇ ਸਾਡਾ ਬਹੁਤ ਭਾਰੀ ਨੁਕਸਾਨ ਹੋਇਆ ਅਤੇ ਸਾਨੂੰ ਹੋਰ ਦੁਕਾਨਦਾਰਾਂ ਨੇ ਵੀ ਸਲਾਹ ਦਿੱਤੀ ਕਿ ਲੋਇਡ ਕੰਪਨੀ ਦੀ ਐਲ ਈ ਡੀ ਨਾ ਵਰਤੋਂ ਹੋਰ ਕੰਪਨੀ ਵਧੀਆ ਕੰਪਨੀ ਦੀ ਐਲ ਈ ਡੀ ਲੈਣੀ ਚਾਹੀਦੀ ਹੈ